ਸਿਲਾਈ ਅਤੇ ਬੁਣਾਈ ਨੇ ਸਾਡੇ ਜੀਵਨ ਨੂੰ ਹਰ ਪੱਖੋਂ ਬਹੁਤ ਪ੍ਰਭਾਵਿਤ ਕੀਤਾ ਹੈ ਕਿਉਂਕਿ ਅਸੀਂ ਅੱਜ ਕੱਲ੍ਹ ਸਿਰਫ ਕੱਪੜੇ ਪਾਉਣਾ ਹੀ ਨਹੀਂ ਸਗੋਂ ਉਹਨਾਂ ਨੂੰ ਆਧੁਨਿਕ ਤਰੀਕੇ ਨਾਲ ਫੈਸ਼ਨਰੇਬਲ ਬਣਾਉਂਦੇ ਹਾਂ ਅਤੇ ਜਿਸ ਵਿੱਚ ਸਿਲਾਈ ਦਾ ਬਹੁਤ ਵੱਡਾ ਰੋਲ ਅਦਾ ਹੁੰਦਾ ਹੈ ਇਸੇ ਤਰ੍ਹਾਂ ਬੁਣਾਈ ਦਾ ਕੰਮ ਕਰਕੇ ਵੀ ਸਾਨੂੰ ਬਹੁਤ ਵਧੀਆ ਲੱਗਦਾ ਹੈ ਇਹ ਦੋਨੋਂ ਕੰਮ ਕਰਨ ਨਾਲ ਸਾਡੀ ਇਨਕਮ ਵੀ ਵਧੀਆ ਹੋ ਜਾਂਦੀ ਹੈ ਅਤੇ ਦੂਸਰਾ ਅਸੀਂ ਆਪਣੇ ਘਰ ਵਿੱਚ ਸਿਲਾਈ ਕਰਦੇ ਹਾਂ ਤਾਂ ਸਾਡੇ ਕੋਲ ਬਹੁਤ ਬੀਬੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜਿੱਥੇ ਇਹ ਕਮਾਈ ਦਾ ਸਾਧਨ ਹੈ ਉੱਥੇ ਮਨੋਰੰਜਨ ਦਾ ਸਾਧਨ ਵੀ ਹੈ ਸਾਨੂੰ ਘਰ ਬੈਠੇ ਹੀ ਚਾਰ ਚੁਫੇਰੇ ਦੀ ਖਬਰ ਮਿਲਦੀ ਰਹਿੰਦੀ ਹੈ ਦੂਸਰਾ ਨਵੇਂ ਨਵੇਂ ਡਿਜ਼ਾਇਨ ਬੱਚਿਆਂ ਲਈ ਤਿਆਰ ਕਰਨਾ ਦੇਖਦੇ ਹਾਂ ਅੱਜ ਕੱਲ੍ਹ ਬੱਚਿਆਂ ਦੇ ਬਹੁਤ ਸਾਰੇ ਡਿਜ਼ਾਇਨ ਸਿਲਾਈ ਵਿੱਚੋਂ ਹੀ ਨਿਕਲਦੇ ਨੇ ਇਹ ਸਭ ਤੋਂ ਵਧੀਆ ਹੈ ਕਿ ਜਿੰਨਾਂ ਡਿਜ਼ਾਇਨ ਬਣਦਾ ਹੈ ਉੱਨੀ ਇਨਕਮ ਵੱਧਦੀ ਹੈ ਪਰ ਸਾਨੂੰ ਸਿਲਾਈ ਅਤੇ ਬੁਣਾਈ ਦੀ ਇਨਕਮ ਤੋਂ ਆਪਣੀ ਮਰਜ਼ੀ ਨਾਲ ਖਰਚਾ ਕਰਨਾ ਬਹੁਤ ਵਧੀਆ ਲੱਗਦਾ ਹੈ ਮੈਨੂੰ ਸਿਲਾਈ ਦਾ ਕੰਮ ਕਰਕੇ ਬਹੁਤ ਸਕੂਨ ਮਿਲਦਾ ਹੈ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਖਰਚੇ ਵਿੱਚ ਆਪਣਾ ਹੱਥ ਵਟਾਉਂਦੀ ਹਾਂ ਪਰ ਲਗਾਤਾਰ ਸਿਲਾਈ ਦਾ ਕੰਮ ਕਰਕੇ ਨਿਗ੍ਹਾ ਜ਼ਰੂਰ ਘੱਟਦੀ ਹੈ